ਫੇਸਬੁੱਕ ਟਵਿਟਰ ਹੁਣ ਐਕਸ ਅਤੇ ਇੰਸਟਾਗ੍ਰਾਮ ਤਿੰਨੋਂ ਹੀ ਲੋਕਾਂ ਨੂੰ ਆਪਸੀ ਜੁੜਾਓ ਜਾਣਕਾਰੀ ਸਾਂਝੀ ਕਰਨ ਅਤੇ ਮਨੋਰੰਜਨ ਪ੍ਰਦਾਨ ਕਰਨ ਲਈ ਵਧੀਆ ਸੋਸ਼ਲ ਮੀਡੀਆ ਪਲੇਟਫਾਰਮ ਹਨ ਫੇਸਬੁੱਕ ਉਪਭੋਗਤਾਵਾਂ ਨੂੰ ਦੋਸਤਾਂ ਨਾਲ ਅਤੇ ਪਰਿਵਾਰ ਨਾਲ ਜੁੜਨ ਦਾ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਨ ਅਤੇ ਵਿਆਪਾਰ ਜਾਂ ਰੁਚੀ ਨਾਲ ਸੰਬੰਧਿਤ ਸਮੂਹਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੰਦਾ ਹੈ ਟਵਿਟਰ ਜਿਹਨੂੰ ਹੁਣ ਐਕਸ ਕਿਹਾ ਜਾਂਦਾ ਏ ਤੇਜ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਚਾਰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੇ ਖਾਸ ਕਰਕੇ ਨਿਊਜ਼ ਰਾਜਨੀਤੀ ਅਤੇ ਮਨੋਰੰਜਨ ਨਾਲ ਜੁੜੇ ਵਿਅਕਤੀਆਂ ਲਈ ਇੰਸਟਾਗ੍ਰਾਮ ਵਿਜ਼ੂਅਲਜ਼ ਉੱਤੇ ਧਿਆਨ ਕੇਂਦਰਿਤ ਪਲੇਟਫਾਰਮ ਹੈ ਜਿੱਥੇ ਲੋਕ ਆਪਣੀਆਂ ਤਸਵੀਰਾਂ ਵੀਡੀਓਜ਼ ਅਤੇ ਗੱਲਾਂ ਸ਼ੇਅਰ ਕਰਕੇ ਲੋਕ ਪ੍ਰਸਿੱਧੀ ਹਾਸਿਲ ਕਰ ਸਕਦੇ ਹਨ ਇਹ ਤਿੰਨਾਂ ਹੀ ਪਲੇਟਫਾਰਮ ਵਿਅਕਤੀਗਤ ਅਤੇ ਵਪਾਰਿਕ ਦੋਹਾਂ ਪੱਧਰਾਂ 'ਤੇ ਬਹੁਤ ਮਦਦਗਾਰ ਹਨ ਕਿਉਂਕੀ ਇਹ ਲੋਕਾਂ ਨੂੰ ਆਪਣੇ ਵਿਚਾਰ ਰੁਚੀਆਂ ਅਤੇ ਵਿਵਹਾਰਿਕ ਗਤੀਵਿਧੀਆਂ ਦਾ ਪ੍ਰਚਾਰ ਕਰਨ ਦੀ ਅਜ਼ਾਦੀ ਦਿੰਦੇ ਹਨ